ਸਾਡੇ ਪਿੰਡ ਵਿੱਚ ਬਿਜਲੀ ਲਈ ਬਹੁਤ ਸਾਰੇ ਕੰਮ ਕੀਤੇ ਜਾ ਸਕਦੇ ਨੇ ਪਿੰਡ ਵਿੱਚ ਹਜੇ ਵੀ ਮੀਟਰ ਘਰ ਘਰ ਦੇ ਬਾਹਰ ਹੀ ਲੱਗੇ ਹੋਏ ਹਨ ਜਦਕਿ ਬਾਕੀ ਪਿੰਡਾਂ ਵਿੱਚ ਇਹ ਮੀਟਰ ਘਰਾਂ ਵਿੱਚੋਂ ਕੱਢ ਕੇ ਬਕਸਿਆਂ ਵਿੱਚ ਲਗਾ ਦਿੱਤੇ ਗਏ ਹਨ ਪਹਿਲਾਂ ਤਾਂ ਸਾਡੇ ਪਿੰਡ ਵਿੱਚ ਇਹ ਕੰਮ ਹੋਣਾ ਚਾਹੀਦਾ ਹੈ ਦੂਸਰਾ ਇਸ ਤਰ੍ਹਾਂ ਕਰਨ ਨਾਲ ਜੋ ਤਾਰਾਂ ਦਾ ਜਾਲ ਬਣਿਆ ਹੋਇਆ ਹੈ ਉਹ ਸਹੀ ਹੋ ਜਾਵੇਗਾ ਬਾਕੀ ਤਾਰਾਂ ਕਈ ਜਗ੍ਹਾ ਤੋਂ ਨੰਗੀਆਂ ਹਨ ਜਿਨ੍ਹਾਂ ਨਾਲ ਕਰੰਟ ਲੱਗਣ ਦਾ ਖਤਰਾ ਬਣਿਆ ਰਹਿੰਦਾ ਹੈ ਅਤੇ ਕਈ ਲੋਕ ਇਸ ਜਗ੍ਹਾ ਤੋਂ ਕੁੰਡੀਆਂ ਵੀ ਲਗਾ ਲੈਂਦੇ ਹਨ ਇਹਨਾਂ ਨੂੰ ਰੋਕਣਾ ਚਾਹੀਦਾ ਹੈ ਬਾਕੀ ਪਿੰਡ ਦੇ ਹਰ ਇੱਕ ਗਲੀ ਮੋੜ 'ਤੇ ਲਾਈਟਾਂ ਦਾ ਪ੍ਰਬੰਧ ਵੀ ਹੋਣਾ ਚਾਹੀਦਾ ਹੈ ਸਾਡੇ ਪਿੰਡ ਵਿੱਚ ਖੇਤੀ ਬਿਜਲੀ 'ਤੇ ਹੀ ਨਿਰਭਰ ਕਰਦੀ ਹੈ ਬਿਜਲੀ ਦੁਆਰਾ ਹੀ ਮੋਟਰ ਚਲਾ ਕੇ ਖੇਤਾਂ ਨੂੰ ਸਿੰਚਾਈ ਕੀਤੀ ਜਾਂਦੀ ਹੈ ਖੇਤੀ ਵਿੱਚ ਵਰਤੀਆਂ ਜਾਣ ਵਾਲੀਆਂ ਕਈ ਬਿਜ ਚੀਜ਼ਾਂ ਬਿਜਲੀ 'ਤੇ ਹੀ ਨਿਰਭਰ ਕਰਦੀਆਂ ਹਨ ਜਿਵੇਂ ਮੋਟਰ ਜਨਰੇਟਰ ਟਰੈਕਟਰ ਬਾਕੀ ਹੋਰ ਸਭ ਆਦਿ